ਪਿਛਲੇ ਦਿਨੀਂ ਬਲਦੇਵ ਸਿੰਘ ਸੜਕਨਾਮਾ ਦੀ ਕਿਤਾਬ ਸੜਕਨਾਮਾ ਪੜ੍ਹੀ ਉਹ ਕਿਤਾਬ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਬਲਦੇਵ ਸਿੰਘ ਸੜਕਨਾਮਾ ਉਹਦਾ ਨਾਂ ਸੜਕਨਾਮਾ ਇਸੇ ਕਰਕੇ ਪਿਆ ਕਿਉਂਕਿ ਉਹਦੀ ਇਹ ਲਿਖੀ ਕਿਤਾਬ ਸੜਕਨਾਮਾ ਉਹ ਇਹ ਉਹ ਬਹੁਤ ਆਮ ਲੋਕਾਂ ਦੇ ਵਿੱਚ ਬਹੁਤ ਪ੍ਰਸਿੱਧ ਹੋਈ ਕਿਉਂਕਿ ਬਲਦੇਵ ਸਿੰਘ ਨੇ ਆਪ ਖੁਦ ਡਰਾਈਵਰੀ ਕੀਤੀ ਹਾਲਾਂਕਿ ਉਹ ਸਰਕਾਰੀ ਮਾਸਟਰ ਰਿਟਾਇਰਡ ਹੋਇਆ ਪਰ ਮਾਸਟਰ ਲੱਗਣ ਤੋਂ ਪਹਿਲਾਂ ਉਹ ਕਲਕੱਤੇ ਜਾ ਕੇ ਸੜਕਾਂ 'ਤੇ ਡਰਾਈਵਰਾਂ ਗੱਡੀਆਂ ਚਲਾਈਆਂ ਉਹਨੇ ਅਤੇ ਡਰਾਈਵਰਾਂ ਦੀ ਜ਼ਿੰਦਗੀ ਨੂੰ ਬੜਾ ਨੇੜਿਓਂ ਦੇਖਿਆ ਇਹ ਕਿਤਾਬ ਦੇ ਵਿੱਚ ਡਰਾਈਵਰਾਂ ਦੀਆਂ ਜੋ ਦੁੱਖ ਤਕਲੀਫਾਂ ਹਨ ਜੋ ਉਹਨਾਂ ਦਾ ਚੰਗਾ ਪ ਪਣ ਹੈ ਜਾਂ ਉਸ ਦਾ ਮਾੜਾਪਣ ਹੈ ਉਹਨਾਂ ਦਾ ਉਹ ਇਸ ਕਿਤਾਬ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਬਲਦੇਵ ਸਿੰਘ ਸੜਕਨਾਮਾ ਨੇ ਖੁਦ ਟਰੱਕ ਚਲਾਏ ਖੁਦ ਕਲਕੱਤੇ ਦੀਆਂ ਗਲੀਆਂ ਦੇ ਵਿੱਚ ਘੁੰਮਿਆ ਉਹਦੇ 'ਚ ਉਸਨੇ ਡਰਾਈਵਰਾਂ ਦੀਆਂ ਜੋ ਦੁੱਖ ਤਕਲੀਫਾਂ ਜੋ ਉਹਨਾਂ ਨੂੰ ਮਾਨਸਿਕ ਪੀੜਾ ਕਿਉਂਕਿ ਉਹ ਪਰਿਵਾਰ ਨੂੰ ਛੱਡ ਕੇ ਪੰਜਾਬ ਦੇ ਵਿੱਚੋਂ ਪਰਿਵਾਰ ਨੂੰ ਛੱਡ ਕੇ ਉਹ ਦਿੱਲੀ ਬੰਬੇ ਜਾਂ ਹੋਰ ਉੱਤਰੀ ਭਾਰਤ ਵਿੱਚ ਬਹੁਤ ਥਾਵਾਂ 'ਤੇ ਉਹ ਮਾਲ ਲੈ ਕੇ ਜਾਂਦੇ ਆ ਆਉਂਦੇ ਆ ਔਰ ਮਹੀਨਾ ਮਹੀਨਾ ਦੋ ਦੋ ਤਿੰਨ ਤਿੰਨ ਮਹੀਨੇ ਵੀ ਉਹ ਕਈ ਵਾਰੀ ਪਰਿਵਾਰਾਂ ਨੂੰ ਨਹੀਂ ਮਿਲਦੇ ਤਾਂ ਉਹਨਾਂ ਦੀਆਂ ਜੋ ਆਪਸ ਦੇ ਵਿੱਚ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ ਅਤੇ ਕੁਝ ਉਹਨਾਂ ਦਾ ਨੈਗੇਟਿਵ ਜੋ ਨਾ ਵਾ ਪੱਖੀ ਵਤੀਰਾ ਉਹ ਵੀ ਉਸ ਕਿਤਾਬ ਦੇ ਵਿੱਚ ਪੜ੍ਹ ਕੇ ਪਤਾ ਲੱਗਦਾ ਵੀ ਜੋ ਇਸ ਜਿਹੜੀ ਇਸ ਤਬਕੇ ਦੇ ਵਿੱਚ ਜਿਹੜਾ ਡਰਾਈਵਰੀ ਦੇ ਤਬਕੇ ਦੇ ਵਿੱਚ ਵੀ ਕੁਝ ਮਾੜੇ ਅਨਸਰ ਹੁੰਦੇ ਹਨ ਜਿਹੜੇ ਕਿ ਜ ਜਿਹੜੇ ਕਿ ਇਸ ਪੂਰੇ ਕਿੱਤੇ ਨੂੰ ਹੀ ਬਦਨਾਮ ਕਰਦੇ ਹਨ ਮੈਨੂੰ ਇਹ ਕਿਤਾਬ ਪੜ੍ਹ ਕੇ ਬੜਾ ਆਨੰਦ ਆਇਆ ਕਿਉਂਕਿ ਇੱਕ ਇਸ ਦੀ ਲਿਖਣ ਸ਼ੈਲੀ ਬਹੁਤ ਵਧੀਆ ਸੀ